ਜਿਵੇਂ ਕਿ ਆਪਾਂ ਗੱਲ ਕਰਦੇ ਹੈਗੇ ਹਾਂ ਪ੍ਰਿੰਟ ਮੀਡੀਆ ਹੈ ਨਾ ਅਖਬਾਰਾਂ 'ਤੇ ਜਾਂ ਖ਼ਬਰਾਂ 'ਤੇ ਅਤੇ ਸੋਸ਼ਲ ਮੀਡੀਆ ਵਾਲੀਆਂ ਖ਼ਬਰਾਂ 'ਤੇ ਹੈ ਨਾ ਮੀਡੀਆ 'ਤੇ ਜਿਵੇਂ ਮੰਨ ਕੇ ਚੱਲੋ ਆਪਣਾ ਸੋਸ਼ਲ ਮੀਡੀਆ ਜਿਵੇਂ ਹੈ ਨਾ ਫੇਸਬੁਕ ਆਦਿ ਅਲੱਗ ਅਲੱਗ ਟੀ ਵੀ ਫੇਸਬੁੱਕ 'ਤੇ ਜਿਨ ਜਿਵੇਂ ਪਾ ਦਿੰਦੇ ਨੇ ਖ਼ਬਰਾਂ ਉਹ ਕਈ ਵਾਰ ਗਲਤ ਹੋ ਜਾਂਦੀਆਂ ਨੇ ਜਦੋਂ ਕਿ ਅਖ਼ਬਾਰਾਂ ਦੇ ਉੱਪਰ ਜਿਹੜੀ ਖ਼ਬਰਾਂ ਆਉਂਦੀਆਂ ਪ੍ਰਿੰਟ ਮੀਡੀਆ ਉਹ ਪਹਿਲਾਂ ਜਾਂਚ ਕਰਦਾ ਖ਼ਬਰ ਦੀ ਵੀ ਸਹੀ ਹੈ ਜਾਂ ਗਲਤ ਹੈ ਹੈ ਨਾ ਅਤੇ ਫਿਰ ਛਾਪਦਾ ਹੈਗਾ ਖ਼ਬਰਾਂ ਨੂੰ ਅਤੇ ਜਿਹੜਾ ਮੈਨੂੰ ਵਧੀਆ ਲੱਗਦਾ ਹੈਗਾ ਤਾਂ ਉਹ ਪ੍ਰਿੰਟ ਮੀਡੀਆ ਵਾਲਾ ਹੀ ਜਿਹੜਾ ਕਿ ਅਖਬਾਰਾਂ ਦੀ ਖ਼ਬਰ ਆਉਂਦੇ ਨੇ ਉਹ ਸਹੀ ਲੱਗਦਾ ਹੈਗਾ ਕਿਉਂਕਿ ਮੈਂ ਜ਼ਿਆਦਾਤਰ ਪੜ੍ਹਨਾ ਅਖਬਾਰਾਂ 'ਤੇ ਹੀ ਪਸੰਦ ਕਰਦੀ ਹਾਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਇੰਸਟਾ 'ਤੇ ਜਿੱਦਾਂ ਵੀ ਜਿਹੜੀਆਂ ਵੀ ਆਪਾਂ ਟੀਵੀਆਂ 'ਤੇ ਹੈ ਨਾ ਉਹ ਕਈ ਵਾਰ ਉਹ ਗਲਤ ਨਿੱਕਲ ਜਾਂਦੀ ਨੇ ਖ਼ਬਰਾਂ ਤਾਂ ਜ਼ਿਆਦਾਤਰ ਲਾਈਕ ਜਿਹੜਾ ਕਰਦੇ ਹੈ ਅਖ਼ਬਾਰਾਂ ਨੂੰ ਕਿਉਂਕਿ ਆਸੇ ਪਾਸੇ ਦੇਖ ਕੇ ਕੀ ਚੱਲ ਰਿਹਾ ਗਾ ਖ਼ਬਰਾਂ ਸਹੀ ਹੁੰਦੀਆਂ ਨੇ ਜੇ ਗੱਲ ਆਪਾਂ ਸੋਸ਼ਲ ਮੀਡੀਆ ਦੀ ਕਰੀਏ ਵੀ ਮੰਨ ਕੇ ਚੱਲੋ ਫੇਸਬੁਕ ਵਗੈਰਾ 'ਤੇ ਤਾਂ ਹਾਂ ਉਹ ਵੀ ਦੇਖਦੇ ਹੈਗੇ ਐਗੇ ਤਾਂ ਉਹਨਾਂ ਤੋਂ ਵੀ ਆਪਾਂ ਨੂੰ ਇਹ ਪਤਾ ਲੱਗਦਾ ਰਹਿੰਦਾ ਹੈਗਾ ਵੀ ਆਪਣੇ ਆਸ ਪਾਸ ਦੇ ਵਿੱਚ ਕੀ ਚੱਲ ਰਿਹਾ ਹੈਗਾ ਤਾਂ ਪਾਰਟੀਬਾਜ਼ੀ ਦਾ ਪਤਾ ਲੱਗਦਾ ਰਹਿੰਦਾ ਵੀ ਕੀ ਚੱਲ ਰਿਹਾ ਗਾ ਹੈ ਨਾ ਸਰਕਾਰਾਂ ਦਾ